ਪੰਜਾਬੀ ਸਲਵਾਰਾਂ ਦੀਆਂ ਅਲੱਗ ਅਲੱਗ ਕਿਸਮਾਂ ਹੁੰਦੀਆਂ ਹਨ ਜਿਵੇਂ ਕਿ ਸਿੰਪਲ ਸਲਵਾਰ ਹੁੰਦੀ ਹੈ ਜਿਹੜੀ ਉਹ ਵੀ ਵਧੀਆ ਲੱਗਦੀ ਹੈ ਫਿਰ ਹੁਣ ਹੁੰਦੀ ਜਿਹੜੀ ਪਟਿਆਲਾ ਸਲਵਾਰ ਉਹ ਵੀ ਵਧੀਆ ਲੱਗਦੀ ਹੈ ਉਹ ਪਟਿਆਲਾ ਸਲਵਾਰ ਸਭ ਤੋਂ ਵਧੀਆ ਲੱਗਦੀ ਹੈ ਜਿਵੇਂ ਲੰਬੀਆਂ ਮੁਟਿਆਰਾਂ ਹੁੰਦੀਆਂ ਹਨ ਉਹਨਾਂ ਨੂੰ ਇਹ ਪਟਿਆਲਾ ਸਲਵਾਰ ਬਹੁਤ ਬਹੁਤ ਜੱਚਦੀ ਆ ਜ ਜਚ ਨਾਲ ਜਿਵੇਂ ਉਹਨਾਂ ਨੇ ਪੰਜਾਬੀ ਜੁੱਤੀ ਪਾਈ ਹੋਵੇ ਉਹਨੂੰ ਵੀ ਬੜੀ ਵਧੀਆ ਲੱਗਦੀ ਆ ਹੁਣ ਅੱਜ ਕੱਲ੍ਹ ਜਿਵੇਂ ਨਵਾਂ ਫੈਸ਼ਨ ਚੱਲਦਾ ਪਿਆ ਧੋਤੀ ਸਲਵਾਰ ਦਾ ਮੇਰੀ ਸਹੇਲੀ ਨੇ ਮੈਨੂੰ ਕਿਹਾ ਕਿ ਤੂੰ ਵੀ ਸਵਾ ਇੱਕ ਸੂਟ ਹੁਣ ਮੈਂ ਵੀ ਇੱਕ ਸੂਟ ਦੇ ਕੇ ਆਈ ਹਾਂ ਦਰਜੀ ਨੂੰ ਪਟਿ ਇਹਦੇ ਧੋਤੀ ਸਲਵਾਰ ਦਾ ਹੁਣ ਦੇਖੋ ਉਹ ਕਿੱਦਾਂ ਦਾ ਲੱਗਦਾ ਹੈ ਜਦੋਂ ਹੁਣ ਦ ਦਰਜੀ ਕੋਲੋਂ ਵਾਪਿਸ ਲੈਣ ਜਾਵਾਂਗੀ ਪਾ ਕੇ ਦੇਖਦੀ ਹਾਂ ਫਿਰ ਮੈਂ ਹੁਣ ਪਟਿਆਲਾ ਸਲਵਾਰਾਂ ਕਿੰਨੀਆਂ ਹੀ ਆਪਣੀਆਂ ਸਵਾ ਲਈਆਂ ਹੋਈਆਂ ਨੇ ਪੰਜਾਬੀ ਸੂਟ ਤਾਂ ਫਿਰ ਲੱਗਦੇ ਹੀ ਵਧੀਆ ਸਲਵਾਰਾਂ ਦੇ ਨਾਲ ਨੇ ਸੂਟ ਤਾਂ ਉੱਦਾਂ ਹੀ ਬੜੇ ਵਧੀਆ ਲੱਗਦੇ ਨੇ ਜੋ ਵੀ ਪਾਵੇ ਸੂਟ ਅਤੇ ਉਹਨੂੰ ਜੱਚਦਾ ਹੀ ਜੱਚਦਾ ਬਾਕੀ ਹੁਣ ਧੋਤੀ ਸਲਵਾਰ ਦੇਖੋ ਹੁਣ ਕਿੱਦਾਂ ਦੀ ਲੱਗਦੀ ਹੈ ਮੇਰੇ ਮੰਮੀ ਵੀ ਹਮੇਸ਼ਾ ਸਲਵਾਰ ਸੂਟ ਹੀ ਪਾਉਂਦੇ ਨੇ ਉਹਨਾਂ ਨੂੰ ਵੀ ਹੁਣ ਮੈਂ ਜਦ ਮੈਨੂੰ ਵਧੀਆ ਲੱਗਾ ਤਾਂ ਮੈਂ ਆਪਣੇ ਮੰਮੀ ਨੂੰ ਵੀ ਕਹਾਂਗੀ ਕਿ ਪਾਣਗੇ ਇਹੀ ਧੋਤੀ ਸਲਵਾਰ ਦੇਖੋ ਬਾਕੀ ਸਲਵਾਰਾਂ ਤੇ ਵੈਸੇ ਬਹੁਤ ਸਾਰਿਆਂ ਨੂੰ ਜੱਚਦੀਆਂ ਨੇ ਅਤੇ ਹੁਣ ਹੋਰ ਕਿੰਨੇ ਹੀ ਸੂਟ ਹੇਗੇ ਮੇਰੇ ਕੋਲ ਲਾਲ ਰੰਗ ਦਾ ਨੀਲੇ ਰੰਗ ਦਾ ਪੀਲਾ ਕਾਲਾ ਚਿੱਟਾ ਸਾਰੇ ਰੰਗਾਂ ਦੇ ਮੇਰੇ ਕੋਲ ਸੂਟ ਹੈਗੇ ਨੇ ਸਾਰੇ ਹੀ ਸੂਟ ਬੜੇ ਹੀ ਸੋਹਣੇ ਹੈਗੇ ਨੇ